ਸਵੇਰ ਦੀ ਸੈਰ ਸਾਡੇ ਲਈ ਬਹੁਤ ਜ਼ਰੂਰੀ ਹੈ ਸਵੇਰੇ ਸਵੇਰੇ ਦੌੜਨਾ ਜਾਂ ਜੋਗਿੰਗ ਕਰਨਾ ਸਾਡੀ ਸਿਹਤ ਲਈ ਬਹੁਤ ਜ਼ਰੂਰੀ ਹੈ ਇਸ ਨਾਲ ਨਾ ਤਾਂ ਸਾਨੂੰ ਕੋਈ ਬਿਮਾਰੀ ਲੱਗਦੀ ਹੈ ਅਤੇ ਨਾ ਹੀ ਸਾਡੇ ਸਰੀਰ ਵਿੱਚ ਕੋਈ ਦਿੱਕਤ ਹੁੰਦੀ ਹੈ ਇਸ ਨਾਲ ਅਸੀਂ ਸਿਹਤਮੰਦ ਰਹਿੰਦੇ ਹਾਂ ਸਵੇਰੇ ਸਵੇਰੇ ਦੌੜਨਾ ਸਰੀਰ ਲਈ ਬਹੁਤ ਚੰਗਾ ਹੁੰਦਾ ਹੈ ਇਸ ਨਾਲ ਸਾਡੇ ਫੇਫੜੇ ਸਹੀ ਰਹਿੰਦੇ ਹਨ ਸਾਨੂੰ ਕਦੇ ਵੀ ਸਾਹ ਲੈਣ 'ਚ ਪ੍ਰੋਬਲਮ ਨਹੀਂ ਹੋਵੇਗੀ ਸਾਨੂੰ ਹਰ ਰੋਜ਼ ਸਵੇਰੇ ਉੱਠ ਕੇ ਦੌੜਨਾ ਜਾਂ ਜੋਗਿੰਗ ਕਰਨੀ ਚਾਹੀਦੀ ਹੈ